ਹਾਂ ਮੈਂ ਆਪਣੇ ਵਿਹੜੇ ਵਿੱਚ ਪੌਦੇ ਅਤੇ ਪੰਛੀਆਂ ਨੂੰ ਆਕਰਸ਼ਿਤ ਕਰਨ ਲਈ ਇੱਕ ਜਗ੍ਹਾ ਬਣਾਈ ਹੋਈ ਹੈ ਮੈਂ ਆਪਣੇ ਵਿਹੜੇ ਵਿੱਚ ਪੌਦੇ ਲਗਾਏ ਹੋਏ ਹਨ ਜਿਹਦੇ ਵਿੱਚ ਕਿ ਮਨੀ ਪਲਾਂਟ ਅਤੇ ਔਲੋਵੀਰਾ ਅਤੇ ਦੁਪਹਿਰ ਬੂਟੀ ਵਗੈਰਾ ਦੇ ਬੂਟੇ ਲਗਾਏ ਹੋਏ ਮੈਂ ਆਪਣੇ ਘਰ ਵਿੱਚ ਇੱਕ ਤੋਤਾ ਵੀ ਰੱਖਿਆ ਹੋਇਆ ਹੈ ਜਿਸ ਦਾ ਨਾਮ ਮੈਂ ਮਿੱਠੂ ਰੱਖਿਆ ਹੋਇਆ ਹੈ ਮਿੱਠੂ ਮੇਰੇ ਨਾਲ ਬਹੁਤ ਹੀ ਗੱਲਾਂ ਮਾਰਦਾ ਹੈ ਮੈਂ ਉਸ ਨੂੰ ਚੂਰੀ ਦਿੰਦੀ ਹਾਂ ਉਹ ਰਾਮ ਰਾਮ ਵੀ ਬੋਲਦਾ ਹੈ ਮਿੱਠੂ ਮੈਨੂੰ ਬਹੁਤ ਹੀ ਚੰਗਾ ਲੱਗਦਾ ਹੈ ਮੈਨੂੰ ਸ਼ੁਰੂ ਤੋਂ ਹੀ ਪੌਦਿਆਂ ਅਤੇ ਪੰਛੀਆਂ ਨਾਲ ਬਹੁਤ ਪਿਆਰ ਹੈ ਮੈਂ ਕੁਆਰੀ ਹੁੰਦੀ ਵੀ ਆਪਣੇ ਘਰ ਵਿੱਚ ਪੌਦੇ ਲਗਾਏ ਹੁੰਦੇ ਸਨ ਉੱਥੇ ਤਾਂ ਮੈਂ ਇੱਕ ਚਿੜੀਆਂ ਦਾ ਘਰ ਬਣਾਇਆ ਹੁੰਦਾ ਸੀ ਲੱਕੜ ਦਾ ਜਿਹਦੇ ਵਿੱਚ ਕਿ ਮੈਂ ਰੰਗ ਬਰੰਗੀਆਂ ਚਿੜੀਆਂ ਰੱਖੀਆਂ ਹੁੰਦੀਆਂ ਸਨ ਹੁਣ ਵੀ ਮੈਂ ਮਿੱਠੂ ਨੂੰ ਬਹੁਤ ਹੀ ਪਿਆਰ ਨਾਲ ਰੱਖਦੀ ਹਾਂ ਮਿੱਠੂ ਨੂੰ ਮੈਂ ਚੂਰੀ ਵੀ ਦਿੰਦੀ ਹਾਂ ਅਤੇ ਉਸਦੀ ਸਾਫ ਸਫਾਈ ਵੀ ਕਰਦੀ ਹਾਂ ਮੈਂ ਆਪਣੇ ਘਰ ਵਿੱਚ ਕੋਠੇ 'ਤੇ ਚਿੜੀਆਂ ਨੂੰ ਦਾਣਾ ਵੀ ਪਾਉਣ ਜਾਂਦੀ ਹਾਂ ਮੈਂ ਆਪਣੇ ਬੱਚਿਆਂ ਨੂੰ ਰੋਜ਼ ਰੋਟੀ ਬਣਾ ਕੇ ਦਿੰਦੀ ਹਾਂ ਅਤੇ ਉਹ ਚਿੜੀਆਂ ਨੂੰ ਦਾਣਾ ਪਾਉਂਦੇ ਹਨ ਜਿਹਦੇ ਨਾਲ ਕਿ ਮੈਨੂੰ ਉਹਨਾਂ ਨੂੰ ਦਾਣਾ ਪਾਉਣਾ ਬਹੁਤ ਵਧੀਆ ਲੱਗਦਾ ਹੈ ਅਤੇ ਮੈਂ ਉਹਨਾਂ ਨੂੰ ਗੰਦਾ ਦਾਣਾ ਨਹੀਂ ਪਾਉਂਦੀ ਅਤੇ ਮੈਂ ਉਸਦੀ ਰੋਜ਼ ਸਾਫ ਸਫਾਈ ਵੀ ਕਰਦੀ ਹਾਂ ਧੰਨਵਾਦ